ਪੰਜਾਬ ਵਿੱਚ ਖੋਜ ਕੀਤੇ ਜਾਣ ਵਾਲੇ ਪ੍ਰ ਪ੍ਰਮੁੱਖ ਖੇਤਰ ਹਨ ਵਿਗਿਆਨ ਟੈਕਨੋਲਜੀ ਵਿਗਿਆਨ ਦੇ ਬਾਰੇ ਦੇ ਵਿੱਚ ਕਾਫੀ ਖੋਜ ਕੀਤੀ ਜਾ ਰਹੀ ਹੈ ਜਿਹੜੇ ਖੇਤਰ ਹੋਰ ਥਾਵਾਂ 'ਤੇ ਛੱਡੇ ਜਾ ਰਹੇ ਹਨ ਉਨ੍ਹਾਂ ਦੇ ਬਾਰੇ ਖੋਜ ਕੀਤੀ ਜਾ ਰਹੀ ਹੈ ਟੈਕਨੋਲਜੀ ਦੇ ਵਿੱਚ ਨਵੀਂ ਨਵੀਂ ਜੋ ਟੈਕਨੋਲਜੀ ਆ ਰਹੀ ਹੈ ਜਿਵੇਂ ਕਿਸੇ ਚੀਜ਼ ਨੂੰ ਚਲਾਉਣ ਦੇ ਲਈ ਨਵੀਂ ਟੈਕਨੋਲਜੀ ਆ ਜਾਂਦੀ ਹੈ ਤਾਂ ਉਸ ਦੇ ਬਾਰੇ ਖੋਜ ਕੀਤੀ ਜਾਂਦੀ ਹੈ ਅਧਿਐਨ ਅਤੇ ਖੋਜ ਤਾਂ ਜਾਰੀ ਹੀ ਰਹਿੰਦਾ ਹੈ ਇਸਦਾ ਕੋਈ ਅੰਤ ਨਹੀਂ ਹੈ ਅਤੇ ਪੰਜਾਬ ਦੇ ਵਿੱਚ ਵਿਗਿਆਨ ਅਤੇ ਟੈਕਨੋਲਜੀ ਬਾਰੇ ਜ਼ਿਆਦਾ ਜ਼ੋਰ ਦਿੱਤਾ ਜਾ ਰਿਹਾ ਹੈ